ਗਾਣਾ ਗਾਉਣਾ ਵੀ ਨਾ ਆਪਣੇ ਆਪ 'ਚ ਕਲਾ ਹੈ ਅਸੀਂ ਗਾਣਾ ਸੁਣਦੇ ਵੀ ਹਾਂ ਸੁਣਾਉਂਦੇ ਵੀ ਹਾਂ ਅਤੇ ਮੂਵੀਸ 'ਚ ਪਾਉਂਦੇ ਵੀ ਹੈ ਅਸੀਂ ਬਹੁਤ ਸਾਰੇ ਗਾਣੇ ਮੂਵੀਸ 'ਚ ਸੁਣਦੇ ਹਾਂ ਅਤੇ ਅੱਜ ਕੱਲ੍ਹ ਤਾਂ ਯੂਟਿਊਬ ਦਾ ਵੀ ਇੰਨਾ ਸਮਾਂ ਆ ਗਿਆ ਕਿ ਗਾਣੇ ਵੱਡੇ ਤੋਂ ਲੈ ਕੇ ਛੋਟੇ ਬੱਚੇ ਵੀ ਗਾਉਂਦੇ ਆ ਮੇਰਾ ਵੀ ਬਚਪਨ ਤੋਂ ਹੀ ਗਾਣਿਆਂ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀਗਾ ਅਤੇ ਮੇਰੀ ਰੁਚੀ ਉਦੋਂ ਪੈਦਾ ਹੋਈ ਜਦੋਂ ਮੈਂ ਗਾਣਿਆਂ ਦੀ ਬਹੁਤ ਸਾਰੀਆਂ ਮੂਵੀਜ਼ ਦੇਖੀਆਂ ਵੀਡੀਓਸ ਦੇਖੀਆਂ ਉਦੋਂ ਯੂਟੀਊਬ ਦਾ ਸਮਾਂ ਨਹੀਂ ਸੀ ਹੁੰਦਾ ਉਦੋਂ ਮੈਂ ਸੀਗਾ ਸ਼ਾਇਦ ਅੱਠ ਜਾਂ ਨੌਂ ਸਾਲ ਦਾ ਉਸ ਉਮਰ ਵਿੱਚ ਮੈਂ ਕਾਫੀ ਸਾਰੀ ਮੂਵੀ ਦੇਖੀਆਂ ਅਤੇ ਮੈਨੂੰ ਗਾਣਿਆਂ ਵਿੱਚ ਬਹੁਤ ਜ਼ਿਆਦਾ ਮੇਰੀ ਰੁਚੀ ਪੈਦਾ ਹੋ ਗਈ ਮੈਂ ਆਉਂਦੇ ਜਾਂਦੇ ਚਲਦੇ ਤੁਰਦੇ ਬਹਿੰਦੇ ਖੜੇ ਹੁੰਦੇ ਅਤੇ ਕੰਮ ਕਰਦੇ ਗਾਣਾ ਗਾਉਣਾ ਸ਼ੁਰੂ ਕਰਤਾ ਹੀ ਮੇਰੇ ਦਾਦਾ ਜੀ ਇੱਕ ਕਲਾਸਿਕਲ ਸਿੰਗਰ ਸੀਗੇ ਅਤੇ ਉਹਨਾਂ ਨੇ ਮੈਨੂੰ ਹਰਮੋਨੀਅਮ ਅਤੇ ਤਬਲਾ ਦੋਵੇਂ ਸਿਖਾਏ ਮੈਨੂੰ ਅੱਜ ਹਰਮੋਨੀਅਮ ਅਤੇ ਬਹੁਤ ਸਾਰੇ ਗਾਣੇ ਬਣਾ ਗਾਉਣੇ ਵੀ ਆਉਂਦੇ ਹਨ ਅਤੇ ਹਾਰਮੋਨੀਆ ਬਜਾਣਾ ਵੀ ਆਉਂਦਾ ਹੈ ਮੈਂ ਆਪ ਵੀ ਗਾਣਾ ਗਾ ਲੈਂਦਾ ਅਤੇ ਮੈਂ ਅੱਜ ਸਟੇਜ 'ਤੇ ਵੀ ਖੜੇ ਹੋ ਕੇ ਬਥੇਰੇ ਗਾਣੇ ਗਾਏ ਹਨ ਨਾਲ ਦੇ ਨਾਲ ਗਾਣੇ ਦੇ ਨਾਲ ਮੈਂ ਮੂਵੀਸ 'ਚ ਐਕਟਿੰਗ ਵੀ ਕਰਦਾ ਹਾਂ ਅਸੀਂ ਜਿੰਨੇ ਵੀ ਗਾਣੇ ਗਾਉਂਦੇ ਹਨ ਉਹਨਾਂ ਨੂੰ ਅਸੀਂ ਰਿਕਾਰਡ ਕਰਦੇ ਹਨ ਅਤੇ ਮੈਂ ਕਾਫੀ ਸਾਰੇ ਗਾਣੇ ਰਿਕਾਰਡ ਕਰਕੇ ਯੂਟੀਊਬ 'ਤੇ ਵੀ ਅਪਲੋਡ ਕੀਤੇ ਆ ਅਤੇ ਇੰਸਟਾਗਰਾਮ ਅਤੇ ਸੋਸ਼ਲ ਮੀਡੀਆ ਦੇ ਥਰੂ ਅਸੀਂ ਰੀਲਸ ਵੀ ਪਾਉਂਦਾ ਹਾਂ ਮੈਨੂੰ ਵੀ ਗਾਣਾ ਗਾਉਣਾ ਬਹੁਤ ਪਸੰਦ ਹੈਗਾ ਅਤੇ ਜਦੋਂ ਵੀ ਮੈਨੂੰ ਇੱਕ ਮੇਰਾ ਮਨ ਪਸੰਦ ਗਾਣਾ ਮਿਲਦਾ ਹੈ ਮੈਂ ਉਹਨੂੰ ਗਾਉਣ ਵੀ ਲੱਗ ਪੈਂਦਾ ਹਾਂ ਕਿ ਅਤੇ ਸੁਣਨ ਵੀ ਲੱਗ ਪੈਦਾ ਹਾਂ ਮੈਂ ਗਾਣਾ ਗਾ ਗਾਉਂਦੇ ਗਾਉਂਦੇ ਬਹੁਤ ਗਾਣੇ ਸੁਣਦਾ ਹਾਂ ਮੈਂ ਪੜ੍ਹ ਦੇ ਵੇਲੇ ਵੀ ਗਾਣਾ ਸੁਣਦਾ ਹਾਂ